ਗਾਇਨ ਵਿੱਚ ਸਾਹ ਨਿਯੰਤਰਨ ਅਤੇ ਸਹਾਇਤਾ ਦੀ ਭੂਮਿਕਾ ਬਾਰੇ ਇਸ ਪ੍ਰਕਾਰ ਚਰਚਾ ਕਰਦੇ ਹਾਂ ਗਾਣਾ ਗਾਉਂਦੇ ਸਮੇਂ ਸਾਹ ਲੈਣ ਤੋਂ ਪਹਿਲਾਂ ਆਪਣੇ ਸਰੀਰ ਦੀ ਸਥਿਤੀ ਸਹੀ ਕਰ ਲਓ ਆਪਣਾ ਪੇਟ ਅੰਦਰ ਹੋਵੇ ਛਾਤੀ ਬਾਹਰ ਨੂੰ ਫੁੱਲੀ ਹੋਈ ਹੋਵੇ ਸਾਹ ਹਮੇਸ਼ਾ ਨੱਕ ਰਾਹੀਂ ਲੈਣਾ ਹੈ ਤਾਂ ਜੋ ਆਪਣਾ ਜੋ ਸੁਰਯੰਤਰ ਹੈ ਉਸ ਵਿੱਚ ਕੋਈ ਰੁਕਾਵਟ ਜਾਂ ਵਾਧਾ ਨਾ ਆਵੇ ਸਾਹ ਲੰਬਾ ਲੈਣਾ ਹੈ ਲੰਬਾ ਸਾਹ ਲੈਣਾ ਹੈ ਅਤੇ ਸਾਹ ਨੱਕ ਦੇ ਨਾਲ ਲੈਣਾ ਹੈ ਸਾਹ ਲੈਂਦੇ ਅਤੇ ਛੱਡਦੇ ਸਮੇਂ ਆਪਣੇ ਸੁਰਾਂ ਦਾ ਧਿਆਨ ਲੱਖਣਾ ਹੈ ਅਤੇ ਉਹ ਸੁਰਾਂ ਦੇ ਨਾਲ ਸਾਹ ਅੰਦਰ ਅਤੇ ਸੁਰਾਂ ਦੇ ਨਾਲ ਸਾਹ ਬਾਹਰ ਆਵੇ ਜਿਸ ਨਾਲ ਆਪਣਾ ਗਾਇਨ ਸਹੀ ਤਰੀਕੇ ਨਾਲ ਹੋ ਸਕੇ ਅਤੇ ਗਾਇਨ ਕਰਦੇ ਸਮੇਂ ਸਾਹ ਹੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੇਕਰ ਆਪਾਂ ਸਾਹ ਸਹੀ ਤਰੀਕੇ ਨਾਲ ਲੈਂਦੇ ਹਾਂ ਨੱਕ ਰਾਹੀਂ ਲੈਂਦੇ ਹਾਂ ਤਾਂ ਆਪਣਾ ਗਲਾ ਸੁੱਕਦਾ ਨਹੀਂ ਅਤੇ ਆਪਣੀ ਆਵਾਜ਼ ਬੇਰੋਕ ਬਾਹਰ ਆਉਂਦੀ ਹੈ ਅਤੇ ਸੁਰ ਅਤੇ ਤਾਲ ਵੀ ਨਿਯਮ ਵਿੱਚ ਚੱਲਦੇ ਹਨ ਅਤੇ ਵਧੀਆ ਗਾਇਨ ਉਚਾਰੀ ਜਾਂਦਾ ਹੈ ਇਸ ਨੂੰ ਸੁਧਾਰਿਆ ਜਾ ਸਕਦਾ ਹੈ ਇਸ ਨੂੰ ਸੁਧਾਰਨ ਲਈ ਸਾਹ ਨੱਕ ਰਾਹੀਂ ਲਓ ਆਪਣੇ ਆਪ ਨੂੰ ਸਥਿਰ ਰੱਖੋ ਜ਼ਿਆਦਾ ਹਿੱਲੋ ਡੁੱਲੋ ਨਾ ਅਤੇ ਆਪਣੇ ਪੂਰੇ ਜਜ਼ਬਾਤਾਂ ਦੇ ਨਾਲ ਉਸ ਨੂੰ ਗਾਇਨ ਪੂਰਾ ਕਰੋ ਅਤੇ ਗਾਇਨ ਨੂੰ ਸੁਧਾਰਨ ਲਈ ਇਲਾਇਚੀ ਖਾਓ ਮਿਸ਼ਰੀ ਖਾਓ ਜੋ ਗਲੇ ਲਈ ਚੰਗੀ ਹੁੰਦੀ ਹੈ ਮੁਲੱਠੀ ਖਾਓ ਗਲੇ ਲਈ ਚੰਗੀ ਹੁੰਦੀ ਹੈ ਇਸ ਨਾਲ ਆਪਣਾ ਗਾਇਨ ਅਤੇ ਸੁਰਯੰਤਰ ਸਾਫ਼ ਰਹਿੰਦਾ ਹੈ ਅਤੇ ਅਸੀਂ ਰੋਜ਼ਾਨਾ ਦੋ ਘੰਟੇ ਅਭਿਆਸ ਕਰਦਾ ਹਾਂ ਮੈਂ ਰੋਜ਼ਾਨਾ ਜ਼ਿੰਦਗੀ ਵਿੱਚ ਦੋ ਘੰਟੇ ਅਭਿ ਅਭਿਆਸ ਕਰਦਾ ਹਾਂ ਗਾਇਨ ਦਾ